ਦਸ ਦਿਨ ਪਹਿਲਾਂ ਮੈਨੂੰ ਮੇਰਾ ਇੱਕ ਪਾਰਸਲ ਮਿਲਿਆ ਜਿਸ ਵਿੱਚ ਜੈਕਿਟ ਸੀ ਉਹ ਪਾਰਸਲ ਨੂੰ ਦੇਖ ਕੇ ਉਸਦੀ ਪੈਕਜ਼ਿੰਗ ਨੂੰ ਦੇਖ ਕੇ ਮੇਰਾ ਮਨ ਬਹੁਤ ਖਰਾਬ ਹੋਇਆ ਕਿਉਂਕਿ ਉਸਦੀ ਪੈਕਜ਼ਿੰਗ ਬਹੁਤ ਹੀ ਘਟੀਆ ਸੀ ਜਿਸ ਵਿੱਚ ਜੈਕਿਟ ਸੀ ਐਡਿਟ ਮੈਂ ਐਡੀਡਾਸ ਦੀ ਜੈਕਟ ਨੂੰ ਮੰਗਵਾਇਆ ਸੀ ਪਰ ਜਦ ਮੈਨੇ ਆਪਣਾ ਪਾਰਸਲ ਖੋਲ੍ਹਿਆ ਤਾਂ ਉਸ ਵਿੱਚ ਕਿਸੇ ਦੇਸੀ ਕੰਪਨੀ ਦੀ ਜੈਕਟ ਸੀ ਮੇਰਾ ਮਨ ਬਹੁਤ ਹੀ ਪਰੇਸ਼ਾਨ ਹੋ ਗਿਆ ਅਤੇ ਜੋ ਕਿ ਬਹੁਤ ਹੀ ਘਟੀਆ ਗੱਲ ਸੀ ਉਸ ਜੈਕਿਟ ਵਿੱਚ ਬਹੁਤ ਸਾਰੇ ਟੱਕ ਲੱਗੇ ਹੋਏ ਸਨ ਅਤੇ ਜਿਸ ਰੰਗ ਦੀ ਮੈ ਜੈਕਟ ਉਹ ਮੰਗਵਾਈ ਸੀ ਰੰਗ ਵੀ ਕੁਝ ਹੋਰ ਆਇਆ ਅਤੇ ਜਿਹੜੀ ਇਹਨਾਂ ਦੀ ਜਿੱਪਾਂ ਸੀਗੀਆਂ ਉਹ ਸਾਰੀਆਂ ਹੀ ਬਹੁਤ ਹੀ ਘਟੀਆ ਕੁਆਲਟੀ ਦੀ ਸੀ ਅਤੇ ਇੱਕ ਟੁੱਟੀ ਹੋਈ ਸੀ ਦੂਜੀ ਖਰਾਬ ਸੀ ਮੈਂ ਮੇਰਾ ਐਕਸਪੀਰੀਅੰਸ ਬਹੁਤ ਹੀ ਖਰਾਬ ਰਿਹਾ ਕਿਉਂਕਿ ਜਿਸ ਚੀਜ਼ ਬਾਰੇ ਮੈਨੂੰ ਪੂਰੀ ਉਮੀਦ ਸੀ ਕਿ ਉਹ ਚੰਗੀ ਆਏਗੀ ਉਸਨੇ ਮੇਰਾ ਮਨ ਬਹੁਤ ਖਰਾਬ ਕਰ ਦਿੱਤਾ ਜਦੋਂ ਮੈਨੂੰ ਮਿਲੀ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਹੀ ਗੁੱਸਾ ਕੀਤਾ ਕਿਉਂਕਿ ਉਹ ਸੇਮ ਜੈਕਟ ਮੇਰੇ ਸ਼ਹਿਰ ਵਿੱਚ ਵੀ ਮਿਲ ਰਹੀ ਸੀ ਮੈਨੇ ਉਹ ਜੈਕਟ ਤਿੰਨ ਹਜ਼ਾਰ ਦੀ ਮੰਗਵਾਈ ਸੀ ਅਤੇ ਮੇਰੇ ਸ਼ਹਿਰ ਵਿੱਚ ਉਹ ਜੈਕੇਟ ਘੱਟੋ ਘੱਟ ਪੰਦਰਾਂ ਸੌ ਤੱਕ ਦੀ ਮਿਲ ਜਾਂਦੀ ਮੇਰਾ ਜੈਕਿਟ ਮੰਗਵਾਉਣ ਦਾ ਅਕਸਪੀਰੀਅੰਸ ਬਹੁਤ ਹੀ ਖਰਾਬ ਰਿਹਾ ਅੱਗੇ ਤੋਂ ਮੈਂ ਬਹੁਤ ਹੀ ਸੋਚ ਸਮਝ ਕੇ ਆਪਣਾ ਜੈਕਿਟ ਮੰਗਾਉਂਗੀ ਅਗਰ ਮੈਨੇ ਕੁਛ ਔਰ ਵੀ ਮੰਗਵਾਉਣਾ ਹੋਇਆ ਮੈਂ ਬਹੁਤ ਸੋਚ ਸਮਝ ਕੇ ਉਸ ਨੂੰ ਔਡਰ ਕਰੂੰਗੀ